ਸਤਿ ਸ਼੍ਰੀ ਅਕਾਲ ਮੈਂ ਅਭਿਸ਼ੇਕ ਪਠਾਨਕੋਟ ਦਾ ਰਹਿਣ ਵਾਲਾ ਹਾਂ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ ਨੂੰ ਸੱਪ ਲੜ ਜਾਂਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਪਹਿਲੀ ਗੱਲ ਜ਼ਿਆਦਾਤਰ ਸੱਪ ਬਰਸਾਤ ਦੇ ਮੌਸਮ ਵਿੱਚ ਬਾਹਰ ਆਉਂਦੇ ਹਨ ਸਾਨੂੰ ਇਹਨਾਂ ਮੌਸਮ ਵਿੱਚ ਹਮੇਸ਼ਾ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ ਜਿਵੇਂ ਜੋ ਕਿ ਸਾਨੂੰ ਸੱਪ ਦੇ ਡੰਗ ਤੋਂ ਬਚਾ ਸਕਣ ਕਿਉਂਕਿ ਸੱਪ ਦਾ ਡੰਗ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਪਹਿਲੀ ਗੱਲ ਜੇਕਰ ਤੁਹਾਨੂੰ ਸੱਪ ਲੜ ਗਿਆ ਹੈ ਤਾਂ ਤੁਸੀਂ ਪਹਿਲਾਂ ਸੱਪ ਦਾ ਨਿਸ਼ਾਨ ਲੱਭੋ ਨਿਸ਼ਾਨ ਲੱਭਣ ਤੋਂ ਬਾਅਦ ਤੁਸੀਂ ਉਸ ਨਿਸ਼ਾਨ ਨੂੰ ਗੌਰ ਨਾਲ ਦੇਖੋ ਅਤੇ ਉਸ ਦਾ ਨਿਸ਼ਾਨ ਪਹਿਚਾਣੋ ਕਿ ਉਹ ਸੱਪ ਜ਼ਹਿਰੀਲਾ ਹੈ ਵੀ ਹੈ ਕਿ ਨਹੀਂ ਕਿਉਂਕਿ ਕਈ ਵਾਰ ਬਹੁਤ ਸਾਰੇ ਸੱਪ ਅਜਿਹੇ ਵੀ ਹੁੰਦੇ ਹਨ ਜੋ ਕਿ ਜ਼ਹਿਰੀਲੇ ਨਹੀਂ ਹੁੰਦੇ ਪਰ ਇਨਸਾਨ ਦੇ ਮਨ ਵਿੱਚ ਉਹ ਵਹਿਮ ਬੈਠ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਉਹ ਜਿੱਥੇ ਜਗ੍ਹਾ ਸੱਪ ਲੜਿਆ ਹੈ ਉਸ ਜਗ੍ਹਾ ਇੱਕ ਘੁੱਟ ਕੇ ਕੱਪੜਾ ਬੰਨ੍ਹ ਦਿਉ ਤਾਂ ਜੋ ਉਹ ਜ਼ਹਿਰ ਬਾਹਰ ਨਾ ਫੈਲੇ ਉਸ ਤੋਂ ਬਾਅਦ ਤੁਸੀਂ ਐਬੂਲੰਸ ਨੂੰ ਫੋਨ ਕਰੋ ਤਾਂ ਜੋ ਉਸ ਵਿਅਕਤੀ ਨੂੰ ਉਸ ਜ਼ਹਿਰ ਤੋਂ ਬਚਾਇਆ ਜਾ ਸਕੇ ਉਸ ਤੋਂ ਬਾਅਦ ਨਿੰਮ ਦਾ ਲੇਪ ਲਗਾ ਕੇ ਉਸ ਦੇ ਸੱਪ ਦੇ ਨਿਸ਼ਾਨ 'ਤੇ ਲਗਾਇਆ ਜਾਵੇ ਤਾਂ ਜੋ ਗੰਦੇ ਕੀਟਾਣੂ ਜੋ ਕਿ ਸੈੱਪ ਸੱਪ ਦੇ ਜ਼ਹਿਰ ਨਾਲ ਹਨ ਆਏ ਹਨ ਉਹ ਸਾਰੇ ਮਰ ਜਾਣ ਅਤੇ ਉਸ ਬੰਦੇ ਦੀ ਜਾਨ ਬਚਾਈ ਸਕੇ ਨਜ਼ਦੀਕੀ ਮੈਡੀਕਲ ਸਟੋਰ ਨਾਲ ਵੀ ਸਾਨੂੰ ਸੰਪਰਕ ਕਰਨਾ ਚਾਹੀਦਾ ਹੈ ਅਤੇ ਐਂਟੀ ਸੀਰਮ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਜੋ ਕਿ ਸਾਨੂੰ ਸੱਪ ਦੇ ਡੰਗ ਤੋਂ ਬਚਾਉਂਦੀ ਹੈ ਇਹ ਸੀਰਮ ਇੰਜੈਕਸ਼ਨ ਹੈ ਜੋ ਸਾਨੂੰ ਸੱਪ ਦੇ ਡੰਗ ਦਾ ਜ਼ਹਿਰ ਘਟਾਉਂਦੀ ਹੈ ਅਤੇ ਸਾਨੂੰ ਇਸ ਨਾਲ ਲੜਨ ਦੀ ਤਾਕਤ ਦਿੰਦੀ ਹੈ ਸਾਨੂੰ ਹਮੇਸ਼ਾ ਜਦੋਂ ਵੀ ਸੱਪ ਲੜਦਾ ਹੈ ਹਮੇਸ਼ਾ ਸਾਨੂੰ ਕਾਮ ਰਹਿਣਾ ਚਾਹੀਦਾ ਹੈ ਤਾਂ ਜੋ ਘਬਰਾਉਣਾ ਨਹੀਂ ਕਿਉਂਕਿ ਇਹ ਗੱਲ ਹੈ ਕਿ ਜਦੋਂ ਵੀ ਸੱਪ ਲੜਦਾ ਹੈ ਸਾਨੂੰ ਹਮੇਸ਼ਾ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਜ਼ਿਆਦਾ ਡਰ ਨਹੀਂ ਡਰਨਾ ਨਹੀਂ ਚਾਹੀਦਾ